ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਖੇਡ ਸੰਸਥਾਵਾਂ ਜਾਂ ਫਿਰ ਰਚਨਾ ਹਨ ਜੋ ਕਿ ਸਾਡੇ ਰਾਜ ਵਿੱਚ ਵੱਖ ਵੱਖ ਖੇਡਾਂ ਨੂੰ ਸੰਚਾਲਿਤ ਕਰਦੀਆਂ ਹਨ ਅਤੇ ਉਤਸਾਹਿਤ ਕਰਦੀਆਂ ਹਨ ਜਿਵੇਂ ਕਿ ਸਾਡੇ ਅ ਦੇਸ਼ ਵਿੱਚ ਕ੍ਰਿਕਟ ਹੈ ਕ੍ਰਿਕਟ ਨੂੰ ਵੀ ਖੇਡਣ ਵਾਸਤੇ ਕ੍ਰਿਕਟ ਨੂੰ ਵੀ ਖੇਡਣ ਵਾਸਤੇ ਜਿਵੇਂ ਕਿ ਵੱਖ ਵੱਖ ਸੰਚਾਲਿਤ ਕਰਦੇ ਹਨ ਅਤੇ ਉਹਨਾਂ ਨੂੰ ਖੇਡਣ ਵਾਸਤੇ ਸਾਨੂੰ ਜਿਵੇਂ ਸਮਝਾਇਆ ਜਾਂਦਾ ਹੈ ਕਿ ਕਿਵੇਂ ਕੀ ਕਿਵੇਂ ਬੋਲ ਪੈਂਦੀ ਹੈ ਅਤੇ ਕਿਵੇਂ ਬੈਟਿੰਗ ਕੀਤੀ ਜਾਂਦੀ ਹੈ ਉਵੇਂ ਹੀ ਫੁੱਟਬੋਲ ਵੀ ਹੈ ਜਿਵੇਂ ਵਿੱਚ ਫੁੱਟਬੋਲ ਵਿੱਚ ਵੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਗੋਲ ਕੀਤਾ ਜਾਂਦਾ ਹੈ ਅਤੇ ਉਵੇਂ ਹੀ ਬਾਸਕਟਬੋਲ ਵਗੈਰਾ ਬਹੁਤ ਸਾਰੀਆਂ ਖੇਡਾਂ ਜਿਵੇਂ ਬਾਸਕਟਬੋਲ ਵਿੱਚ ਵੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਬਾਸਕਟ ਵਿੱਚ ਬੋਲ ਨੂੰ ਕੀਤਾ ਜਾਂਦਾ ਹੈ ਅਤੇ ਐਵੇਂ ਹੀ ਹੋਰ ਵੀ ਬਹੁਤ ਸਾਰੇ ਹੋਕੀ ਵੀ ਜਿਵੇਂ ਹੋਕੀ ਵੀ ਜਿਵੇਂ ਗੇਮ ਲਾ ਲਓ ਹੋਕੀ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਕਿਵੇਂ ਹੋਕੀ ਨਾਲ ਅਤੇ ਗੋਲ ਕੀਤਾ ਜਾਂਦਾ ਹੈ ਅਤੇ ਐਵੇਂ ਐਵੇਂ ਹੀ ਹੋਰ ਵੀ ਬਹੁਤ ਸਾਰੀਆਂ ਗੇਮਾਂ ਜਿਵੇਂ ਕਿ ਹੋਰ ਲਾ ਲਓ ਫੁੱਟਬੋਲ ਵਗੈਰਾ ਫੁੱਟਬੋਲ ਵਿੱਚ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਫੁੱਟਬਾਲ ਨੂੰ ਫੁੱਟਬੋਲ ਨਾਲ ਗੋਲ ਕੀਤਾ ਜਾਂਦਾ ਹੈ ਹੋਰ ਵੀ ਬਹੁਤ ਹਾ ਹਾਕੀ ਜਿਵੇਂ ਦੂਜੇ ਹੋਕੀਆਂ ਦੇ ਗੋਲਫ ਵਾਲਾ ਗੋਲਫ ਵਾਲੀ ਗੇਮ ਲਗਾ ਲਓ ਗੋਲਫ ਵਿੱਚ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਗੋਲਫ ਵਗੈਰਾ ਨੂੰ ਗੋਲਫ ਨਾਲ ਗੋਲ ਕੀਤਾ ਜਾਂਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਕਿ ਜਿਵੇਂ